ਜਿਵੇਂ ਕਿ ਮੈਨੂੰ ਹੈ ਨਾ ਘੁੰਮਣਾ ਫਿਰਨਾ ਬਹੁਤ ਪਸੰਦ ਟਰੈਵਲਿੰਗ ਕਰਨਾ ਬਹੁਤ ਪਸੰਦ ਹੈ ਕਿ ਮੈਂ ਇੱਕ ਜਗ੍ਹਾ ਬੈਠ ਨਹੀਂ ਸਕਦੀ ਹੈ ਨਾ ਕਿ ਜਿੱਦਾਂ ਇੱਕ ਬੰਦਾ ਘੁੰਮਦਾ ਫਿਰਦਾ ਰਹਿੰਦਾ ਬੰਦੇ ਦਾ ਦਿਮਾਗ ਫਰੈਸ਼ ਰਹਿੰਦਾ ਹੈ ਨਾ ਜਿੱਦਾਂ ਕਿ ਮੈਂ ਹਰ ਸਾਲ ਦੀਵਾਲੀ ਦਿਨ ਪਹਿਲਾਂ ਨੈਣਾ ਦੇ ਇੱਥੇ ਆਪਣੇ ਆਨੰਦਪੁਰ ਸਾਹਿਬ ਨਾ ਉੱਥੇ ਮੱਥਾ ਟੇਕਣ ਜਾਂਦੇ ਹੀ ਜਾਂਦੇ ਹੈ ਅਤੇ ਉਹਤੇ ਅੱਗੇ ਅਸੀਂ ਫਿਰ ਉਹ ਤੋਂ ਬਾਅਦ ਮੱਥਾ ਆਨੰਦਪੁਰ ਸਾਹਿਬ ਮੱਥਾ ਟੇਕ ਕੇ ਉਸ ਤੋਂ ਬਾਅਦ ਅਸੀਂ ਆਪਣੇ ਨੈਣਾ ਦੇਵੀ ਜਿਹੜਾ ਮੰਦਰ ਆ ਮਾਤਾ ਦਾ ਨਾ ਉੱਥੇ ਮੱਥਾ ਟੇਕ ਕੇ ਮੈਂ ਆਉਂਦੀ ਹਾਂ ਨਾ ਅਤੇ ਉਹ ਤੋਂ ਬਾਅਦ ਜਿਹੜਾ ਚੰਡੀਗੜ੍ਹ ਸਾਰਾ ਰੋਕ ਗਾਰਡਨ ਰੋਜ਼ ਗਾਰਡਨ ਮਤਲਬ ਬਹੁਤ ਚੀਜ਼ ਘੁੰਮਣ ਵਾਲੀ ਬੰਦਾ ਕਿ ਇੰਜੋਏ ਕਰਦਾ ਹੈ ਨਾ ਅਤੇ ਬਹੁਤ ਜਗ੍ਹਾ ਘੁੰਮਣ ਵਾਲੇ ਜਿਹਦੇ 'ਚ ਮਤਲਬ ਬੰਦਾ ਕਹਿੰਦੇ ਕਿ ਹਾਂ ਹੈ ਨਾ ਕਿ ਬੰਦਾ ਮਨ ਟਾਈਮ ਪਾਸ ਬੰਦੇ ਦਾ ਅਤੇ ਮਨ ਵੀ ਵਧੀਆ ਰਹਿੰਦਾ ਆਪਣਾ ਦਿਮਾਗ ਫਰੈਸ਼ ਰਹਿੰਦਾ ਮਤਲਬ ਕੋਈ ਟੈਂਸ਼ਨ ਵਗੈਰਾ ਕੁਛ ਰਹਿੰਦੀ ਨਹੀਂ ਹੈ ਨਾ ਘੁੰਮਣਾ ਬੰਦੇ ਨੂੰ ਚਾਹੀਦਾ ਹੈ ਹਰ ਕਿਸੇ ਨੂੰ ਕਿ ਅੱਜ ਜਾਣਾ ਚਾਹੀਦਾ ਕਿ ਉਹ ਵਧੀਆ ਮਤਲਬ ਕਿ ਗੋਲਡਨ ਟੈਂਪਲ ਤਾਂ ਬੰਦਾ ਜਾਂਦਾ ਹੀ ਰਹਿੰਦਾ ਹੈ ਨਾ ਗੋਲਡਨ ਟੈਂਪਲ ਬਹੁ ਵਧੀਆ ਚੀਜ਼ ਆ ਬੰਦਾ ਮੱਥਾ ਟੇਕ ਲੈਂਦਾ ਹੈ ਨਾ ਹਰਿਮੰਦਰ ਸਾਹਿਬ ਜਿੱਦਾਂ ਨਾ ਅਤੇ ਆਪਣਾ ਟਿੱਬੀ ਸਾਹਿਬ ਹੋ ਗਿਆ ਤਾਂ ਬੰਦਾ ਮਤਲਬ ਕਿ ਬੰਦੇ ਨੂੰ ਕਹਿਣ ਦਾ ਭਾਵ ਇਹ ਹੈ ਕਿ ਬੰਦੇ ਨੂੰ ਬੈਠਣਾ ਨਹੀਂ ਚਾਹੀਦਾ ਮਤਲਬ ਘੁੰਮਣਾ ਫਿਰਨਾ ਚਾਹੀਦਾ ਹੈ ਨਾ ਦਿਮਾਗ ਮਤਲਬ ਚੰਗਾ ਸਿਹਤ ਸਿਹਤ ਵੀ ਚੰਗੀ ਰਹਿੰਦੀ ਅਤੇ ਬੰਦੇ ਦਾ ਇੰਨਾ ਸੋਚਦਾ ਨਹੀਂ ਹੈ ਨਾ ਅਤੇ ਮੈਨੂੰ ਘੁੰਮਣਾ ਫਿਰਨਾ ਬਹੁਤ ਪਸੰਦ ਆ ਮਤਲਬ ਜਗ੍ਹਾ ਜਗ੍ਹਾ ਜਾਣਾ ਨਵੀਂ ਨਵੀਂ ਜਗ੍ਹਾ ਜਾਣਾ ਹਾਂਜੀ ਅਤੇ ਇਸ ਤੋਂ ਇਲਾਵਾ ਬਾਕੀ ਹੋਰ ਨਵਾਂ ਘੁੰਮਣ ਜਗ੍ਹਾ ਹੈਗੀਆਂ ਤਾਂ ਆਪਾਂ ਘੁੰਮਣ ਜਾਵਾਂਗੇ ਹੈ ਨਾ